ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਖੂਹ ਕੀ ਹੁੰਦੇ ਸੀ ਖੂਹ ਵਿੱਚੋਂ ਪਾਣੀ ਕੱਢਣ ਲਈ ਹਲਟੀ ਦੀ ਵਰਤੋਂ ਕਰਕੇ ਅਤੇ ਦੂਜਾ ਬਾਲਟੀ ਨੂੰ ਰੱਸੀ ਬੰਨ ਕੇ ਉਸ ਦੁਆਰਾ ਪਾਣੀ ਕੱਢਿਆ ਜਾਦਾ ਸੀ ਪਰ ਅੱਜ ਦੇ ਮਸ਼ੀਨੀ ਯੁੱਗ ਵਿੱਚ ਮਸ਼ੀਨਾਂ ਨਾਲ ਬੋਰ ਕਰਕੇ ਬਿਜਲੀ ਦੀ ਵਰਤੋਂ ਕਰਕੇ ਧਰਤੀ ਚੋਂ ਪਾਣੀ ਬਾਹਰ ਕੱਢਿਆ ਜਾਂਦਾ ਹੈ ਅਤੇ ਇਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ